ਸਾਡੇ ਪੰਜਾਬ ਵਿੱਚ ਸਾਡੇ ਮੁੱਖ ਆਗੂ ਸ਼੍ਰੀ ਗੁਰੂ ਨਾਨਕ ਦੇਵ ਜੀ ਹੈ ਸਾਡੇ ਸ਼੍ਰੀ ਗੁਰੂ ਨਾਨਕ ਦੇਵ ਜੀ ਨੇ ਸਾਡੇ ਲਈ ਵੀਹ ਰੁਪਈਏ ਦੇ ਲੰਗਰ ਚਲਾਏ ਅਤੇ ਹੋਰ ਬਹੁਤ ਜ਼ਿਆਦਾ ਕੁਰਬਾਨੀਆਂ ਦਿੱਤੀਆਂ ਸਾਨੂੰ ਬਾਣੀ ਪੜ੍ਹਨ ਦਾ ਅਤੇ ਹੋਰ ਸਭ ਸੰਸਾਰ ਦਾ ਸਤਿਕਾਰ ਕਰਨ ਬਾਰੇ ਦੱਸਿਆ ਅਤੇ ਹੋਰ ਦਸਾਂ ਨਹੁੰਆਂ ਦੀ ਕਿਰਤ ਬਾਰੇ ਅਤੇ ਹੋਰ ਸਾਰੇ ਕੰਮਾਂ ਬਾਰੇ ਦੱਸਿਆ ਗਿਆ ਅਤੇ ਅਸੀਂ ਸਿੱਖ ਧਰਮ ਵਿੱਚ ਚੰਗੀ ਕਿਰਤ ਕਰਨੀ ਆ ਵੰਡ ਕੇ ਛਕਣਾ ਹੈ ਅਤੇ ਹੋਰ ਸਾਰਿਆਂ ਦਾ ਸਤਿਕਾਰ ਕਰਨਾ ਹੈ ਹੋਰ ਸਾਡੇ ਸਿੱਖ ਆਗੂ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਹੈ ਜਿਨ੍ਹਾਂ ਨੇ ਸਾਡੇ ਲਈ ਆਪਣੇ ਚਾਰੇ ਬੱਚੇ ਵਾਰੇ ਅਤੇ ਦੋ ਚਮਕੌਰ ਸਾਹਿਬ ਬਾਬਾ ਅਜੀਤ ਸਿੰਘ ਜੀ ਅਤੇ ਜੁਝਾਰ ਸਿੰਘ ਜੀ ਦੋ ਨੀਹਾਂ ਵਿੱਚ ਚਿਣਵਾਏ ਗਏ ਸ਼੍ਰੀ ਫਤਿਹਗੜ੍ਹ ਸਾਹਿਬ ਬਾਬਾ ਜ਼ੋਰਾਵਰ ਸਿੰਘ ਜੀ ਅਤੇ ਬਾਬਾ ਫਤਿਹ ਸਿੰਘ ਜੀ ਇਹਨਾਂ ਨੇ ਸਾਡੇ ਲਈ ਬਹੁਤ ਵੱਡੀਆਂ ਵੱਡੀਆਂ ਕੁਰਬਾਨੀਆਂ ਦਿੱਤੀਆਂ ਮੈਂ ਆਪਣੇ ਬਹੁਤ ਗੁਰੂਆਂ ਪੀਰਾਂ ਦਾ ਸਤਿਕਾਰ ਕਰਦੀ ਹਾਂ ਕਿ ਮਹਾਰਾਜ ਸਾਨੂੰ ਬਾਣੀ ਨਾਲ਼ ਜੋੜੀ ਰੱਖੇ ਅਸੀਂ ਮਹਾਰਾਜ ਦਾ ਹਰ ਟਾਇਮ ਸਤਿਕਾਰ ਕਰਦੇ ਰਹੀਏ